ਇਹ ਗੱਲ ਸੱਚ ਹੈ ਕਿ ਮੌਸਮ ਬਾਈਕਿੰਗ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਕੀਤੀ ਜਾਂਦੀ ਬਾਈਕਿੰਗ ਸਾਡਾ ਪਸੀਨਾ ਵਹਾਉਂਦੀ ਹੈ ਅਤੇ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀ ਹੈ ਬਾਈਕਿੰਗ ਦੇ ਦੁਆਰਾ ਅਸੀਂ ਆਪਣੀਆਂ ਲੱਤਾਂ ਦੀਆਂ ਐਕਸਰਸਾਈਜ ਕਰ ਸਕਦੇ ਹਾਂ ਇਸ ਦੇ ਨਾਲ ਗੋਡੇ ਨੂੰ ਬਹੁਤ ਫ਼ਾਇਦਾ ਹੁੰਦਾ ਹੈ ਅਤੇ ਗੋਡਿਆਂ ਦੀ ਬਹੁਤ ਵਧੀਆ ਐਕਸਰਸਾਈਜ਼ ਦੇ ਲਈ ਬਾਈਕਿੰਗ ਮੰਨੀ ਜਾਂਦੀ ਹੈ ਅਤੇ ਸਾਡੇ ਬਹੁਤ ਸਾਰੇ ਜਵਾਨ ਜੋ ਹਨ ਬਾਈਕਿੰਗ ਕਰਕੇ ਇਨਾਮ ਵੀ ਪ੍ਰਾਪਤ ਕਰਦੇ ਹਨ ਅੱਜ ਕੱਲ੍ਹ ਇਹ ਇਕ ਫੈਸ਼ਨ ਬਣਦਾ ਜਾ ਰਿਹਾ ਹੈ ਪਰ ਇਹ ਮੌਸਮ ਦੇ ਹਿਸਾਬ ਨਾਲ ਵੀ ਇੱਕ ਬਹੁਤ ਵਧੀਆ ਮੰਨਿਆ ਜਾਂਦਾ ਹੈ ਬਾਈਕਿੰਗ ਸਰਦੀਆਂ ਦੇ ਵਿੱਚ ਵੀ ਕੀਤੀ ਜਾ ਸਕਦੀ ਹੈ ਅਤੇ ਸਰਦੀਆਂ ਦੇ ਵਿੱਚ ਸਾਨ ਸਾਡੀ ਠੰਡ ਨੂੰ ਘੱਟ ਕਰਦੀ ਹੈ ਜਿਸ ਦੇ ਨਾਲ ਸਾਡਾ ਸਰੀਰ ਗਰਮ ਹੁੰਦਾ ਹੈ ਅਤੇ ਸਾਡੀਆਂ ਮਾਸਪੇਸ਼ੀਆਂ ਵਧੀਆ ਢੰਗ ਦੇ ਨਾਲ ਕੰਮ ਕਰਦੀਆਂ ਹਨ ਅਤੇ ਸਰਦੀਆਂ ਵਿੱਚ ਪੈਦਾ ਹੁੰਦੀ ਫੈਟ ਨੂੰ ਖਤਮ ਕਰਨ ਦੇ ਵਿੱਚ ਬਾਈਕਿੰਗ ਦਾ ਬਹੁਤ ਵਧੀਆ ਰੋਲ ਹੈ ਅਤੇ ਗਰਮੀਆਂ ਦੇ ਵਿੱਚ ਮੋਟਾਪੇ ਤੋਂ ਪਰੇਸ਼ਾਨ ਲੋਕ ਬਾਈਕਿੰਗ ਕਰਕੇ ਆਪਣਾ ਵਜ਼ਨ ਬੜੀ ਆਸਾਨੀ ਨਾਲ ਘੱਟ ਕਰ ਸਕਦੇ ਹਨ ਧੰਨਵਾਦ